ਕਿਤਾਬਾਂ ਪੜ੍ਹਨ ਦਾ ਅਖ਼ਬਾਰ ਪੜ੍ਹਨ ਦਾ ਮੈਨੂੰ ਕਾਫ਼ੀ ਸ਼ੌਂਕ ਹੈ ਤਾਂ ਇੱਕ ਵਾਰ ਛੋਟੇ ਹੁੰਦਿਆਂ ਨੇ ਮਤਲਬ ਹੁਣ ਤਾਂ ਨਹੀਂ ਛੋਟੇ ਹੁੰਦਿਆਂ ਨੇ ਕਿਤਾਬ ਪੜ੍ਹੀ ਆ ਚੁਟਕਲਿਆਂ ਵਾਲੀ ਜਿਹਦੇ ਵਿੱਚ ਬੜੇ ਹੀ ਮਤਲਬ ਅਟਪਟੇ ਚਟਪਟੇ ਚੁਟਕਲੇ ਸੀ ਤਾਂ ਉਹ ਚੁਟਕਲਿਆਂ ਨੂੰ ਪੜ੍ਹਦੇ ਪੜ੍ਹਦੇ ਮਤਲਬ ਉਹ ਛੋਟੇ ਹੁੰਦੇ ਸੀ ਜਦੋਂ ਤਾਂ ਇੰਨਾਂ ਪਤਾ ਵੀ ਨਹੀਂ ਹੁੰਦਾ ਸੀ ਤਾਂ ਉਹ ਸੁਣਾਉਣੇ ਘਰਦਿਆਂ ਨੂੰ ਸੁਣਾਉਣੇ ਤਾਂ ਮਤਲਬ ਅਸੀਂ ਐਂਈ ਹੱਸਦੇ ਰਹਿੰਦੇ ਹੁੰਦੇ ਸੀ ਹਸਾਉਂਦੇ ਰਹਿੰਦੇ ਹੁੰਦੇ ਸੀ ਨਿਊਜ਼ਪੇਪਰ ਦੇ ਵਿੱਚ ਵੀ ਅਸੀਂ ਖਾਸ ਕਰ ਸਪੈਸ਼ਲ ਜਦੋਂ ਆਉਂਦਾ ਹੁੰਦਾ ਸੀ ਇੱਕ ਸੈਕਸ਼ਨ ਜਿਹਦੇ ਵਿੱਚ ਗੂਗਲੀ ਚਾਚਾ ਚੌਧਰੀ ਉਹਦੇ ਵਿੱਚ ਵੀ ਜੋਕਸ ਚੁਟਕਲੇ ਆਉਂਦੇ ਹੁੰਦੇ ਸੀ ਬੁਝਾਰਤਾਂ ਵੀ ਆਉਂਦੀਆਂ ਸੀ ਬਸ ਉਹਨਾਂ ਨੂੰ ਪੜ੍ਹਦੇ ਪੜ੍ਹਦੇ ਛੋਟੇ ਹੁੰਦੇ ਨਾਲ਼ੇ ਹੱਸਦੇ ਸੀ ਨਾਲ਼ੇ ਹਸਾਉਂਦੇ ਸੀ ਬਸ ਇੱਦਾਂ ਹੀ ਚੱਲਦਾ ਰਹਿੰਦਾ ਸੀ